ਉਪਰੋਕਤ ਖੇਡਾਂ ਵਿੱਚੋਂ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਕੈਰਮ ਖੇਲਣਾ ਚੰਗਾ ਲੱਗਦਾ ਹੈ ਇਹ ਕੈਰਮ ਪਰਿਵਾਰ ਦੇ ਵਿੱਚ ਖੇਡੀ ਜਾਂਦੀ ਹੈ ਅਤੇ ਇਹ ਘਰ ਦੇ ਅੰਦਰ ਬੈਠ ਕੇ ਹੀ ਖੇਡੀ ਜਾ ਸਕਦੀ ਹੈ ਅਤੇ ਇਹ ਖੇਡ ਖੇਡਣ ਨਾਲ ਪਰਿਵਾਰਿਕ ਸਾਂਝ ਬਣੀ ਰਹਿੰਦੀ ਹੈ ਇਹ ਖੇਡ ਖੇਡਣ ਲਈ ਇੱਕ ਲੱਕੜੀ ਦਾ ਚੌੜਾ ਚੋਰਸ ਫੱਟਾ ਚਾਹੀਦਾ ਹੁੰਦਾ ਹੈ ਜਿਸ ਦੇ ਵਿੱਚ ਚਾਰ ਮੋਰੀਆਂ ਬਣੀਆ ਹੁੰਦੀਆਂ ਹਨ ਚਾਰੋਂ ਕੋਨਿਆਂ ਦੇ ਵਿੱਚ ਅਤੇ ਨੀਚੇ ਜਾਲੀ ਲੱਗੀ ਹੁੰਦੀ ਹੈ ਇਹ ਖੇਡਣ ਲਈ ਚਿੱਟੀਆਂ ਅਤੇ ਕਾਲੀ ਗਿੱਟੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਇੱਕ ਗੁਲਾਬੀ ਗੀਟੀ ਵੀ ਹੁੰਦੀ ਹੈ ਇਹ ਖੇਡ ਖੇਡਣ ਲਈ ਸਭ ਤੋਂ ਜ਼ਿਆਦਾ ਜੱਦੋ ਜਹਿਦ ਗੁਲਾਬੀ ਗੀਟੀ ਨੂੰ ਪਾਉਣ ਲਈ ਕੀਤੀ ਜਾਂਦੀ ਹੈ ਜਿਹੜਾ ਬੰਦਾ ਇਸ ਗੁਲਾਬੀ ਗੀਟੀ ਨੂੰ ਪਾ ਲੈਂਦਾ ਹੈ ਉਹ ਹੀ ਜ਼ਿਆਦਾ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ ਇਹ ਖੇਡ ਖੇਡਣ ਲੱਗਿਆ ਬਹੁਤ ਹੀ ਅਨੰਦ ਭਰਪੂਰ ਸਮਾਂ ਹੋਇਆ ਹੋਇਆ ਹੁੰਦਾ ਹੈ